ਹਾਂਜੀ ਜਿੱਥੋਂ ਤੱਕ ਅਸੀਂ ਸੈਰ ਦੀ ਗੱਲ ਕਰੀਏ ਸੈਰ ਸਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਹੈ ਸੈਰ ਦੇ ਨਾਲ ਸਾਡੀ ਸਰੀਰ 'ਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੂਰ ਹੁੰਦੀਆਂ ਔਰ ਵਰਕਿੰਗ ਕਪੈਸਟੀ ਵੱਧ ਜਾਂਦੀ ਹੈ ਅਸੀਂ ਆਪਣੇ ਆਪ ਨੂੰ ਫਿੱਟ ਮਹਿਸੂਸ ਕਰਦੇ ਹਾਂ ਮੈਂ ਕਿਸੇ ਦੀ ਕੀ ਗੱਲ ਕਰਨੀ ਮੈਂ ਆਪਣੀ ਗੱਲ ਕਰਦੀ ਕਿ ਮੈਨੂੰ ਖੁਦ ਨੂੰ ਸੈਰ ਦਾ ਬਹੁਤ ਸ਼ੌਂਕ ਹੈ ਅਤੇ ਮੇਰੇ ਹਸਬੈਂਡ ਨੂੰ ਵੀ ਅਸੀਂ ਤਕਰੀਬਨ ਸੈਰ ਕਰਨਾ ਸਾਡੇ ਇੱਥੇ ਨਾਲ ਹੀ ਆ ਉੱਥੇ ਜਾਂਦੇ ਹਾਂ ਲੇਕਿਨ ਥੋੜ੍ਹੀ ਜਿਹੀ ਇਹ ਮੁਸ਼ਕਿਲ ਆ ਕੀ ਅੱਜ ਕੱਲ੍ਹ ਏਵੇਂ ਕਿ ਇਹਨੂੰ ਥੋੜ੍ਹਾ ਬਿਹਤਰ ਬਣਾਉਣਾ ਚਾਹੀਦਾ ਉੱਥੇ ਇੱਕ ਤਾਂ ਸਾਫ਼ ਸਫ਼ਾਈ ਦੀ ਬਹੁਤ ਜ਼ਿਆਦਾ ਕਮੀ ਹੈ ਸਫ਼ਾਈ ਨਹੀਂ ਆ ਪ੍ਰੋਪਰ ਜਿੱਥੇ ਅਸੀਂ ਬੈਠ ਕੇ ਆਪਣੇ ਯੋਗਾ ਕਰ ਸਕੀਏ ਸਿੰਪਲ ਸੈਰ ਹੀ ਹੁੰਦੀ ਹੈ ਯੋਗਾ ਵਗੈਰਾ ਨਹੀਂ ਹੁੰਦਾ ਹਾਂ ਇਹਨਾਂ ਨੂੰ ਥੋੜ੍ਹਾ ਜਿਹਾ ਮਤਲਬ ਕਿ ਮਸ਼ੀਨਾਂ ਵਗੈਰਾ ਲਗਾਉਣੀਆਂ ਚਾਹੀਦੀਆਂ ਜਿਸ ਤਰ੍ਹਾਂ ਐਕਸਰਸਾਈਜ਼ ਵਾਲੀਆਂ ਮਸ਼ੀਨਾਂ ਹੁੰਦੀਆਂ ਜੇ ਲੋਕੀਂ ਹੁਣ ਜਿੰਮ 'ਚ ਜਾਂਦੇ ਆ ਉੱਥੇ ਪੈਸੇ ਵੀ ਲੱਗਦੇ ਹੁੰਦੇ ਆ ਸਰਕਾਰ ਨੂੰ ਚਾਹੀਦਾ ਕਿ ਪਾਰਕਾਂ ਵਿੱਚ ਐਹੋ ਜਿਹੇ ਪਾਰਕ ਹੋਣੇ ਚਾਹੀਦੇ ਆ ਕਿ ਕੁਛ ਕੁਛ ਦੂਰੀ 'ਤੇ ਲੱਗੀ ਹੋਣੀ ਚਾਹੀਦੀ ਕਿ ਸਭ ਨੂੰ ਆਪਣੇ ਘਰ ਦੇ ਕੋਲ ਐਹੋ ਜਿਹੀ ਫੈਸਿਲਿਟੀ ਮਿਲ ਜਾਵੇ ਅਤੇ ਉਹ ਇਸ ਚੀਜ਼ ਦਾ ਲਾਭ ਉਠਾਲੇ ਤਾਂ ਕਿ ਅਸੀਂ ਇਹਨਾਂ ਬਿਮਾਰੀਆਂ ਤੋਂ ਦੂਰ ਹੋ ਜਾਈਏ ਸੈਰ ਮਸ਼ੀਨਾਂ ਲੱਗਣ ਦੇ ਨਾਲ ਜਿਹੜੇ ਜਿੰਮ ਵਿੱਚ ਜਾ ਜਾ ਕੇ ਕਰਦੇ ਆ ਐਕਸਰਸਾਈਜ਼ ਉਹ ਸਾਨੂੰ ਉੱਥੇ ਹੀ ਮਿਲਜੇ ਉੱਥੇ ਇੱਕ ਐਹੋ ਜਿਹਾ ਰੂਮ ਹੋਣਾ ਚਾਹੀਦਾ ਜਿੱਥੇ ਅਸੀਂ ਆਪਣੀ ਪ੍ਰੋਪਰ ਐਕਸਰਸਾਈਜ਼ ਕਰ ਲਈਏ ਅਤੇ ਆਪਣੇ ਆਪ ਨੂੰ ਫਿੱਟ ਕਰ ਲਈਏ ਸਰਕਾਰ ਨੂੰ ਇਹਦੇ ਬਾਰੇ ਜ਼ਰੂਰ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਇਸ ਸਭ ਕਹਿ ਤੋਂ ਸਭ ਤੋਂ ਕਹਿੰਦੇ ਨਾ ਜ਼ਰੂਰੀ ਸਿਹਤ ਆ ਸਿਹਤ ਦਾ ਮੁੱਦਾ ਜਿੱਥੇ ਹੋਵੇ ਉੱਥੇ ਸਰਕਾਰ ਨੂੰ ਇਹ ਜ਼ਰੂਰ ਇਹਦਾ ਕੋਈ ਨਾ ਕੋਈ ਕਦਮ ਉਠਾਉਣਾ ਚਾਹੀਦਾ